ਹਾਂਜੀ ਸਰ ਨਮਸਕਾਰ ਜੀ ਸਰ ਜੀ ਜੀ ਸਰ ਠੀਕ ਹੈ ਸਰ ਸਰ ਉਸ ਲਈ ਤੁਸੀਂ ਹੁਣ ਕਿਹੜੀ ਸਿੰਮ ਯੂਜ ਕਰ ਰਹੇ ਹੋ ਠੀਕ ਹੈ ਜੀ ਪੁੱਜ ਗਏ ਨੇ ਠੀਕ ਹੈ ਸਰ ਮੈਂ ਤੁਹਾਨੂੰ ਦੱਸਣਾ ਚਾਹਵਾਂਗਾ ਕਿ ਵੈਸੇ ਤਾਂ ਰਿਲਾਇੰਸ ਦੀ ਫੋਰ ਜੀ ਸਿੰਮ ਵੀ ਆਪਣੇ ਕੋਲ ਅਵੇਲੇਬਲ ਹੈ ਫਾਇਵ ਜੀ ਵੀ ਅਵੇਲੇਬਲ ਹੈ ਉਸ ਲਈ ਸਰ ਤੁਹਾਨੂੰ ਆਪਣਾ ਮੋਬਾਈਲ ਜਿੱਦਾਂ ਤੁਹਾਡਾ ਫੋਨ ਸਰ ਥਰੀ ਜੀ ਸਟ ਸੂਟੇਬਲ ਹੋਏਗਾ ਅਤੇ ਆਪਣਾ ਮੋਬਾਈਲ ਵੀ ਚੇਂਜ ਕਰੋ ਚੈੱਕ ਕਰਕੇ ਅਤੇ ਤੁਹਾਨੂੰ ਸਿੰਮ ਆਪਾਂ ਫੋਰ ਜੀ ਵੀ ਅਵੇਲਬਲ ਕਰਾ ਦਾਂਗੇ ਅਤੇ ਫਾਇਵ ਜੀ ਵੀ ਕਰਾ ਦਾਂਗੇ ਵੈਸੇ ਏਅਰਟੈਲ ਦੀ ਵੀ ਸਾਡੇ ਕੋਲ ਅਵੇਲੇਬਲ ਹੈ ਸਰ ਏਅਰਟੈਲ ਦੀ ਵੀ ਸਰ ਤੁਹਾਨੂੰ ਆਪਾਂ ਫੋਰ ਜੀ ਵੀ ਕਰਾ ਦਾਂਗੇ ਅਤੇ ਫਾਇਵ ਜੀ ਵੀ ਬਟ ਇੱਕ ਚੀਜ਼ ਸਰ ਤੁਸੀਂ ਆਪਣੀ ਮੋਬਾਈਲ ਵਿੱਚ ਚੈੱਕ ਚੈੱਕ ਕਰ ਲਓ ਮੋਬਾਈਲ ਕਿਹੜਾ ਯੂਜ ਕਰ ਰਹੇ ਹੋ ਕਿਤੇ ਥਰੀ ਜੀ ਸੂਟਏਬਲ ਨਾ ਹੋਏ ਇਸ ਕਰਕੇ ਮੋਬਾਈਲ ਵੀ ਚੇਂਜ ਕਰ ਲਓ

ਸਰ ਫੋਨ ਨੰਬਰ ਤੁਹਾਡਾ ਉਹੀ ਰਹੇਗਾ ਜੀ ਤੁਹਾਡਾ ਜੀ ਹਾਂਜੀ ਪੋਰਟ ਹੋ ਜਾਏਗਾ ਸਰ ਪੋਰਟ ਨਹੀਂ ਆਏਗੀ ਸਰ ਫੋਨ ਤੁਹਾਡਾ ਉਹੀ ਰਹੇਗਾ ਪੋਰਟ ਹੋ ਜਾਏਗੀ ਸਰ ਸਿਮ ਸਰ ਪਲਾਨ ਵੱਖ ਵੱਖ ਹੈ ਸਰ ਲਿਮਿਟਡ ਜਿੱਦਾਂ ਤੁਸੀਂ ਰਿਲਾਇੰਸ ਦੀ ਜੇ ਤੁਸੀਂ ਲੈਂਦੇ ਹੋ ਫੋਰ ਜੀ ਉਹ ਤੁਹਾਡਾ ਸਾਡਾ ਮੰਥਲੀ ਡੇਢ ਜੀ ਬੀ ਵੰਨ ਡੇਅ ਪਲਾਨ ਜੀ ਬੀ ਨੈੱਟ ਮਿਲਦਾ ਉਹਦੇ ਵਿੱਚ ਦੋ ਸੌ ਨੜਿਨਵੇਂ ਦਾ ਰੀਚਾਰਜ ਹੈ ਸਰ ਅਣਲਿਮਿਟਡ ਕੋਲ ਹੈ ਸੌ ਸਰ ਟਵੈਂਟੀ ਏਟ ਡੇਜ ਦੀ ਹੈ ਵੈਲਡੀਟੀ ਜਿਹਨੂੰ ਆਪਾਂ ਮੰਥਲੀ ਪੋਟ ਹਾਂਜੀ ਅਠਾਈ ਦਿਨ ਦੀ ਵੈਲਡੀਟੀ ਹੈ ਅਤੇ ਤੁਸੀਂ ਸਰ ਇਹਨੂੰ ਯੂਜ ਕਰ ਸਕਦੇ ਹੋ ਵਧੀਆ ਨੈਟਵਰਕ ਆ ਸਾਡਾ ਅਤੇ ਵਧੀਆ ਰਿਸਪਾਂਸ ਹੈ ਸਰ ਬਹੁਤ ਸਾਰੇ ਕਸਟਮਰ ਸਾਡੇ ਨਾਲ ਜੁੜੇ ਹੋਏ ਸਰ ਬਿਲਕੁਲ ਨਹੀਂ ਆਏਗਾ ਜੀ ਸਾਡੀ ਨੈਟਵਰਕ ਪ੍ਰੋਬਲਮ ਪਹਿਲੇ ਅੱਜ ਤੋਂ ਚਾਰ ਪੰਜ ਸਾਲ ਸੀ ਹੁਣ ਬਿਲਕੁਲ ਸਾਡਾ ਨੈਟਵਰਕ ਕਲੀਅਰ ਹੈ ਸਾਡੀ ਆਪਾਂ ਰੇਂਜ ਉੱਥੇ ਵੀ ਪਹੁੰਚਾਈ ਹੋਈ ਹੈ ਪਿੰਡਾਂ 'ਚ ਬਾਰਡਰ ਏਰੀਏ ਸਾਡਾ ਪੈਂਦਾ ਉੱਥੇ ਵੀ ਸਾਡੇ ਨੈਟਵਰਕ ਬਹੁਤ ਵਧੀਆ ਕੰਮ ਕਰ ਰਹੇ ਨੇ ਸਰ ਬਹੁਤ ਵਧੀਆ ਤਰੀਕੇ ਸਰ ਡਿਸਕਾਊਂਟ ਜਿਹੜੇ ਪਲਾਨ ਜਿਹੜੇ ਆਏ ਆ ਉਹ ਤੁਸੀਂ ਐਪ 'ਚ ਸਰ ਜਾ ਕੇ ਜੀਓ ਐਪ ਡਾਊਨਲੋਡ ਕਰ ਸਕਦੇ ਹੋ ਉਸ 'ਚ ਸਰ ਅਪਡੇਟਿੰਗ ਹੁੰਦੀ ਰਹਿੰਦੀ ਹੈ ਬਾਕੀ ਪਲਾਨ ਇਜ਼ਲੀ ਜਿਹੜਾ ਸਭ ਤੋਂ ਬੈਟਰ ਪਲਾਨ ਆ ਮੰਥਲੀ ਪਲਾਨ ਕਰਾ ਸਕਦੇ ਹੋ ਤੁਸੀਂ ਬਾਕੀ ਟੂ ਮੰਥ ਵੀ ਹੈਗੇ ਆ ਸਰ ਸਿਕਸ ਮੰਥ ਵੀ ਪਲਾਨ ਹੈਗੇ ਆ ਇਹ ਬਾਕੀ ਦੋ ਨਾਇਨਟੀ ਨਾਇਨ ਦਾ ਪਲਾਨ ਸਭ ਤੋਂ ਬੈਟਰ ਹੈ ਅਤੇ ਉਹ ਯੂਸ ਤੁਸੀਂ ਕਰ ਸਕਦੇ ਹੋ ਬਾਕੀ ਨੈਟਵਰਕ ਇਸ਼ੂ ਤੁਹਾਨੂੰ ਇੱਕ ਨਹੀਂ ਹੈ ਬਿਲਕੁਲ ਬਿਲਕੁਲ ਸਰ ਜਾਂ ਤਾਂ ਤੁਸੀਂ ਫਿਰ ਪੋਸਟਪੇਡ ਸਿੰਮ 'ਤੇ ਸਾਡੀ ਇੱਕ ਆਪਸ਼ਨ ਆ ਜਾਂਦੀ ਜੇ ਤੁਸੀਂ ਵਨ ਟੂ ਵਨ ਜੇ ਤੁਸੀਂ ਦੋ ਦੋ ਸਿੰਮਾਂ ਲੈਂਦੇ ਹੋ ਗਵਰਨਮੈਂਟ ਪਲੈਨ ਦੇ ਜੇ ਤੁਹਾਡਾ ਕੋਈ ਇਮਪਲੋਈ ਹੈਗਾ ਜੇ ਤੁਸੀਂ ਜੋਬ ਕਰਦੇ ਹੋ ਤੁਹਾਨੂੰ ਆਪਾਂ ਵਨ ਟੂ ਵਨ ਤੁਹਾਡੀ ਉਹ ਇੱਕ ਸਿੰਮ ਤੁਹਾਡੀ ਫਰੀ ਹੋਏਗੀ ਕਾਲਿੰਗ ਤੁਹਾਡੀ ਫਰੀ ਹੋਏਗੀ ਅਨਲਿਮਿਟਡ ਤੁਹਾਡਾ ਪਲਾਨ ਵੀ ਸਸਤਾ ਹੋਏਗਾ ਬਿਲਕੁਲ ਬਿਲਕੁਲ ਸਰ ਬਿਲਕੁਲ ਜੀ ਓਕੇ ਸਰ ਥੈਂਕ ਯੂ ਸਰ ਕਾਲਿੰਗ ਫੋਰ